ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਵਿੱਚ ਕਈ ਤਰ੍ਹਾਂ ਦੀਆਂ ਫਸਲਾਂ ਉਗਾਈਆਂ ਜਾਂਦੀਆਂ ਹਨ ਜਿਵੇਂ ਕਣਕ ਬਾਜਰਾ ਮੱਕੀ ਝੋਨਾ ਆਦਿ ਇਨ੍ਹਾਂ ਫਸਲਾਂ ਵਿੱਚੋਂ ਝੋਨਾ ਮੁੱਖ ਹੈ ਝੋਨਾ ਝੋਨਾ ਕਰਨ ਤੋਂ ਪਹਿਲਾਂ ਝੋਨੇ ਦੀ ਪਨੀਰੀ ਉਗਾਈ ਜਾਂਦੀ ਹੈ ਪਨੀਰੀ ਤਿਆਰ ਕਰਨ ਤੋਂ ਬਾਅਦ ਉਸਨੂੰ ਇੱਕ ਖੇਤ ਖੇਤ ਸਜਾਉਣਾ ਪੈਂਦਾ ਹੈ ਖੇਤ ਦੀ ਚੰਗੀ ਤਰ੍ਹਾਂ ਮੁਰੱਬਤ ਕਰਕੇ ਉਸ ਵਿੱਚ ਕੱਦੂ ਕੀਤਾ ਜਾਂਦਾ ਹੈ ਫਿਰ ਉਸ ਤੋਂ ਬਾਅਦ ਝੋਨੇ ਦੀ ਅਤੇ ਵਿੱਚ ਪਾਣੀ ਪਾ ਕੇ ਇਹ ਝੋਨੇ ਦੀ ਪਨੀਰੀ ਲਗਾਈ ਜਾਂਦੀ ਹੈ ਜਦੋਂ ਥੋੜ੍ਹਾ ਜਿਹਾ ਝੋਨਾ ਉੱਗ ਜਾਂਦਾ ਹੈ ਤਾਂ ਉਸ ਵਿੱਚ ਘਾਹ ਉੱਗ ਜਾਂਦਾ ਹੈ ਜਿਸ ਨੂੰ ਜਿਸ ਨਾਲ਼ ਸਾਨੂੰ ਗੁਡਾਈ ਕਰਨੀ ਪੈਂਦੀ ਹੈ ਝੋਨਾ ਬਹੁਤ ਹੀ ਵਧੀਆ ਫਸਲ ਹੈ ਝੋਨਾ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਪਹਿਲਾਂ ਵੀ ਸਫਾਈ ਰੱਖਣੀ ਪੈਂਦੀ ਹੈ ਝੋਨਾ ਤਿਆਰ ਹੋਣ ਤੋਂ ਬਾਅਦ ਫਿਰ ਉਸ ਦੀ ਕਟਾਈ ਕੀਤੀ ਜਾਂਦੀ ਹੈ ਜਿਸ ਨੂੰ ਮਸ਼ੀਨਾਂ ਨਾਲ਼ ਜਾਂ ਮਜ਼ਦੂਰਾਂ ਨਾਲ਼ ਕਟਾਇਆ ਜਾਂਦਾ ਹੈ ਫਸਲ ਪੱਕਣ ਤੋਂ ਬਾਅਦ ਕਟਾਈ ਹੋਣ ਤੋਂ ਬਾਅਦ ਉਸ ਤੋਂ ਬਾਅਦ ਉਸ ਨੂੰ ਇਹ ਮੰਡੀਆਂ ਵਿੱਚ ਵੇਚਿਆ ਜਾਂਦਾ ਹੈ ਜਿਸ ਦਾ ਬਜਟ ਸਾਨੂੰ ਬਹੁਤ ਹੀ ਆਸਾਨੀ ਤਰੀਕੇ ਨਾਲ਼ ਮਿਲ ਜਾਂਦਾ ਹੈ ਇਸ ਲਈ ਝੋਨੇ ਦੀ ਫਸਲ ਨੂੰ ਪਾਣੀ ਵਾਰ ਵਾਰ ਲਗਾਤਾਰ ਦੇਣਾ ਪੈਂਦਾ ਹੈ ਸੋ ਝੋਨੇ ਦੀ ਪਤਲ ਫਸਲ ਬਹੁਤ ਹੀ ਵਧੀਆ ਫਸਲ ਹੈ